ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ ਹਰ ਉਮਰ ਵਰਗ ਅਤੇ ਦੇਸ਼ ਦੇ ਲੋਕ ਖੇਡਾਂ ਵੱਲ ਰੁਚਿਤ ਹੁੰਦੇ ਹਨ ਲੋਕ ਖੇਡਾਂ ਲੋਕ ਸਮੂਹ ਦੀ ਸਮੂਹਿਕ ਰਚਨਾ ਹੁੰਦੀਆਂ ਹਨ ਅਤੇ ਸਹਿਜ ਰੂਪ ਵਿੱਚ ਨਿਮਦੀਆਂ ਵਿਗਸਦੀਆਂ ਹਨ ਪੰਜਾਬ ਦੇ ਪਿੰਡਾਂ ਵਿੱਚ ਕਈ ਖੇਡਾਂ ਖੇਡੀਆਂ ਜਾਂਦੀਆਂ ਜੋ ਕਿ ਪਿੰਡਾਂ ਦੇ ਲੋਕ ਦੇ ਸੁਭਾਅ ਵਾਂਗ ਖੁੱਲ੍ਹੀਆਂ ਡੁੱਲੀਆਂ ਸਾਦੀਆਂ ਸਰੀਰਿਕ ਅਤੇ ਮਾਨਸਿਕ ਵਿਕਾਸ ਵਾਲੀਆਂ ਹਨ ਕਬੱਡੀ ਗੁੱਲੀ ਡੰਡਾ ਖਿੱਦੋ ਖੂੰਡੀ ਰੱਸਾ ਕਸੀ ਗੱਤਕਾਬਾਜੀ ਕੋਟਲਾ ਛਪਾਕੀ ਬਾਰਾਂ ਬੀਟੀ ਟਾਪੂ ਸਮੁੰਦਰ ਝੱਗ ਗੁੱਡੀ ਪਟੋਲਾ ਬਿੱਲੀ ਮਾਸੀ ਅੱਡੀ ਟੱਪਾ ਕੁਸ਼ਤੀਆਂ ਰੱਸੀ ਟੱਪਣੀ ਆਦਿ ਖੇਡਾਂ ਪਿੰਡਾਂ ਵਿੱਚ ਖੇਡੀਆਂ ਜਾਂਦੀਆਂ ਹਨ ਇਹਨਾਂ ਖੇਡਾਂ ਨੂੰ ਖੇਡਣ ਵਾਲਾ ਸਮਾਨ ਵੀ ਆਮ ਹੀ ਹੁੰਦਾ ਹੈ ਜਿਵੇਂ ਰੱਸੀ ਗੀਟੇ ਇੱਟਾਂ ਰੋੜੇ ਲੱਕੜ ਕੋਲਾ ਡੰਡਾ ਗੁੱਲੀ ਖੁੰਡੀਆਂ ਪੁਰਾਣੇ ਕੱਪੜੇ ਦੀਆਂ ਖਿੱਦੋ ਸੰਦੀਆਂ ਰੱਸੀਆਂ ਆਦਿ ਸ਼ਾਮਿਲ ਹੁੰਦਾ ਹੈ ਬੱਚਿਆਂ ਦੀ ਸਭ ਤੋਂ ਪਿਆਰੀ ਖੇਡ ਗੁੱਲੀ ਡੰਡਾ ਹੁੰਦੀ ਹੈ ਇਹ ਦੋਵੇਂ ਲੱਕੜ ਦੇ ਹੁੰਦੇ ਹਨ ਗੁੱਲੀ ਨੂੰ ਸਿਰਿਆਂ ਤੋਂ ਘੜ ਕੇ ਤਿੱਖੀ ਕਰ ਲਿਆ ਜਾਂਦਾ ਹੈ ਮੈਦਾਨ ਵਿੱਚ ਇੱਕ ਟੋਆ ਪੁੱਟ ਲਿਆ ਜਾਂਦਾ ਹੈ ਖਿਡਾਰੀ ਦੋ ਲਾਈਨਾਂ ਵਿੱਚ ਵੰਡੇ ਜਾਂਦੇ ਹਨ ਵਾਰੀ ਪੁਗਨ ਤੋਂ ਬਾਅਦ ਪਹਿਲੀ ਵਾਰੀ ਲੈਣ ਵਾਲਾ ਗੁੱਲੀ ਨੂੰ ਡੰਡੇ ਨਾਲ ਦੂਰ ਸੁੱਟਦਾ ਹੈ ਵਿਰੋਧੀ ਟੀਮ ਦੇ ਖਿਡਾਰੀ ਗੁੱਲੀ ਡੰਡੇ 'ਤੇ ਮਾਰਦੇ ਹਨ ਜੇ ਨਿਸ਼ਾਨਾ ਡੰਡੇ 'ਤੇ ਜਾ ਕੇ ਲੱਗੇ ਤਾਂ ਪਹਿਲੇ ਦੀ ਵਾਰੀ ਖ਼ਤਮ ਅਤੇ ਜੇ ਨਿਸ਼ਾਨਾ ਨਾ ਲੱਗੇ ਤਾਂ ਫਿਰ ਉਸ ਦੀ ਵਾਰੀ ਆ ਜਾਂਦੀ ਹੈ